ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬੀ ਜਿਹੜੀ ਆ ਉਹ ਸਾਡੀ ਮਾਤ ਭਾਸ਼ਾ ਵਾ ਅਤੇ ਹਿੰਦੀ ਰਾਸ਼ਟਰੀ ਭਾਸ਼ਾ ਵਾ ਜਦੋਂ ਵੀ ਆਪਾਂ ਬੱਚਾ ਸਕੂਲ ਵਿੱਚ ਪੜ੍ਹਨਾ ਪਾਉਂਦੇ ਹਾਂ ਤਾਂ ਉਹਨੂੰ ਸਕੂਲ ਵਿੱਚ ਪਹਿਲਾਂ ਪੰਜਾਬੀ ਹੀ ਸਿਖਾਈ ਜਾਂਦੀ ਆ ਪੰਜਾਬੀ ਬੱਚਾ ਜਲਦੀ ਸਿੱਖਦਾ ਵਾ ਇੱਕ ਤਾਂ ਇਹ ਭਾਸ਼ਾ ਬੜੀ ਆਸਾਨ ਆ ਅਤੇ ਸਿੱਖ ਵੀ ਬੜੇ ਸੌਖੇ ਤਰੀਕੇ ਦੇ ਨਾਲ ਜਾਂਦਾ ਵਾ ਤੇ ਜੇਕਰ ਇਹਦੇ ਮੁਕਾਬਲੇ ਕੁਝ ਵਰਡ ਹੁੰਦੇ ਆ ਜਿਹੜੇ ਪੰਜਾਬੀ ਦੇ ਹਿੰਦੀ ਦੇ ਨਾਲ ਬਹੁਤ ਜ਼ਿਆਦਾ ਮਿਲਦੇ ਜੁਲਦੇ ਆ ਜਦੋਂ ਆਪਾਂ ਬੱਚੇ ਨੂੰ ਸਕੂਲ ਦੇ ਵਿੱਚ ਪੰਛੀਆਂ ਦੇ ਨਾਂ ਕਰਵਾਉਂਦੇ ਹਾਂ ਯਾਦ ਜਿਵੇਂ ਕਿ ਹੋ ਗਿਆ ਤੋਤਾ ਮੈਨਾ ਕਬੂਤਰ ਅਤੇ ਹਿੰਦੀ ਦੇ ਵਿੱਚ ਵੀ ਇਵੇਂ ਹੀ ਬੋਲਿਆ ਜਾਂਦਾ ਤੋਤਾ ਮੈਨਾ ਕਬੂਤਰ ਬੱਚਾ ਬੜੀ ਆਸਾਨੀ ਦੇ ਨਾਲ ਇਹ ਚੀਜ਼ਾਂ ਸਿੱਖ ਜਾਂਦਾ ਕੁਝ ਵਰਡ ਹੁੰਦੇ ਆ ਕੁਝ ਸ਼ਬਦ ਹੁੰਦੇ ਆ ਜਿਹੜੇ ਪੰਜਾਬੀ ਦੇ ਵਿੱਚ ਜਾਨਵਰਾਂ ਦੇ ਨਾਂ ਜਿਵੇਂ ਸ਼ੇਰ ਚੀਤਾ ਹਾਥੀ ਇਹ ਵੀ ਜਿਹੜੇ ਆ ਆਪਣੀ ਹਿੰਦੀ ਭਾਸ਼ਾ ਦੇ ਨਾਲ ਹੀ ਮੇਲ ਖਾਂਦੇ ਆ ਉਹ ਵੀ ਬੱਚੇ ਨੂੰ ਬੜੇ ਵਧੀਆ ਆਸਾਨੀ ਦੇ ਨਾਲ ਜਿਹੜੇ ਆ ਉਹ ਯਾਦ ਹੋ ਜਾਂਦੇ ਆ ਕਾਫ਼ੀ ਵ ਕਾਫ਼ੀ ਸ਼ਬਦ ਆ ਜਿਹੜੀ ਆਪਣੀ ਪੰਜਾਬੀ ਭਾਸ਼ਾ ਦੇ ਨਾਲ ਹਿੰਦੀ ਭਾਸ਼ਾ ਜਿਹੜੀ ਆ ਮਿਲਦੀ ਜੁਲਦੀ ਆ ਅਤੇ ਆਪਾਂ ਨੂੰ ਪੜ੍ਹਨ 'ਚ ਵੀ ਆਸਾਨੀ ਹੁੰਦੀ ਆ ਇਹ ਆਪਾਂ ਵਧੀਆ ਤਰੀਕੇ ਨਾਲ ਇਹਨੂੰ ਕਰ ਲੈਂਦੇ ਹਾਂ ਪੰਜਾਬੀ ਭਾਸ਼ਾ ਵੀ ਸੌਖੀ ਆ ਹਿੰਦੀ ਭਾਸ਼ਾ ਵੀ ਸੌਖੀ ਆ